ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਮੈਂ ਨਾ ਪਟਿਆਲੇ ਤੋਂ ਸੰਗਰੂਰ ਨੂੰ ਜਾਣਾ ਕੀ ਤੁਸੀਂ ਅੱਜ ਆ ਸਕਦੇ ਹੋ ਕਾਰ ਲੈ ਕੇ ਹਾਂਜੀ ਹਾਂਜੀ ਸਰ ਥੈਂਕ ਯੂ ਜੀ ਸਰ ਤੁਸੀਂ ਬਸ ਇੱਥੇ ਮੈਨੂੰ ਰ ਸੰਗਰੂਰ ਹੀ ਉਤਾਰ ਦਿਉ ਸਰ ਸਰ ਤੁਸੀਂ ਕੈਸ਼ ਲਉਂਗੇ ਸਾਡੇ ਤੋਂ ਓਕੇ ਕੈਸ਼ ਕਿਉਂ ਨਹੀਂ ਲਉਂਗੇ ਸਰ ਤੁਸੀਂ ਜੇ ਸਰ ਤੁਸੀਂ ਕੈ ਮੇਰੇ ਨਾ ਇੱਥੇ ਮੈਂ ਤੁਹਾਨੂੰ ਔਨਲਾਈਨ ਪੇਮੈਂਟ ਨਹੀਂ ਕਰ ਸਕਦੀ ਕਿਉਂਕਿ ਇਥੇ ਨੈੱਟ ਦੀ ਵੀ ਪ੍ਰੋਬਲਮ ਆ ਰਹੀ ਹੈ ਅਤੇ ਮੇਰਾ ਏ ਟੀ ਐੱਮ ਹੈ ਜਿਹੜਾ ਉਹ ਘਰ ਰਹਿ ਗਿਆ ਇਸ ਕਰਕੇ ਸਰ ਤੁਹਾਨੂੰ ਅੱਜ ਮੇਰੇ ਤੋਂ ਨਗਦ ਪੈਸੇ ਲੈ ਲਉ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਮੇਰੀ ਬੇਨਤੀ ਹੈ ਕਿ ਤੁਸੀਂ ਮੇਰੇ ਤੋਂ ਨਗਦ ਲੈ ਲਉ ਅੱਛਾ ਕਿਉਂ ਨਹੀਂ ਸਰ ਤੁਸੀਂ ਮੇਰੇ ਤੋਂ ਨਗਦ ਲੈ ਰਹੇ ਕੀ ਮਤਲਬ ਕੋਈ ਰੂਲ ਹੋਇਆ ਇੱਦਾਂ ਦਾ ਪਾਸ ਕਿ ਤੁਸੀਂ ਸਿਰਫ ਔਨਲਾਈਨ ਹੀ ਪੇਮੈਂਟ ਕਰਨੀ ਹੈ ਕਿ ਤੁਸੀਂ ਨਗਦ ਪੈਸੇ ਨਹੀਂ ਲੈਣੇ ਕਦੋਂ ਹੋਇਆ ਸਰ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਵੀ ਨਹੀਂ ਮਿਲੀ ਸਰ ਪਲੀਜ਼ ਥੋੜ੍ਹਾ ਜਿਹਾ ਤੁਸੀਂ ਮੈਨੂੰ ਇਸ ਇਸ ਬਾਰੇ ਡਿਟੇਲ 'ਚ ਦੱਸ ਦਿਉ ਤਾਂ ਕਿ ਨੈਕਸਟ ਜਦੋਂ ਵੀ ਅਸੀਂ ਕਦੇ ਦੁਬਾਰਾ ਤੁਹਾਡੀ ਕਾਰ ਬੁੱਕ ਕਰਵਾਉਣੀ ਹੈ ਤਾਂ ਸਾਨੂੰ ਪਹਿਲਾਂ ਪਤਾ ਹੋਵੇ ਕਿ ਅਸੀਂ ਤੁਹਾਨੂੰ ਨਗਦੀ ਜਿੱਦਾਂ ਪੈਸੇ ਦੇਣੇ ਨੇ ਨਹੀਂ ਦੇਣੇ ਅਤੇ ਤੁਸੀਂ ਕੈ ਔਨਲਾਈਨ ਹੀ ਪੇਮੈਂਟ ਲੈਣੀ ਹੈ ਅਸੀਂ ਫਿਰ ਕਿਸੇ ਹੋਰ ਕਾਰ ਵਾਲੇ ਨੂੰ ਸੰਪਰਕ ਕਰਦੇ ਰਹਾਂਗੇ ਸਰ ਪਰ ਤੁਹਾਨੂੰ ਇਹ ਪਹਿਲਾਂ ਦੱਸਣਾ ਚਾਹੀਦਾ ਸੀ ਕਿ ਤੁਸੀਂ ਸਾਨੂੰ ਪੈਸੇ ਹੈ ਜਿਹੜੇ ਉਹ ਨਹੀਂ ਲਉਂਗੇ ਔਨਲਾਈਨ ਪੇਮੈਂਟ ਹੀ ਲਉਂਗੇ ਹਾਂਜੀ ਪਲੀਜ਼ ਇਹੀ ਹੈ ਕਿ ਤੁਸੀਂ ਹਰ ਸ ਮਤਲਬ ਇੱਦਾਂ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਪਰੇਸ਼ਾਨ ਹੋਣਗੇ ਕਿ ਕਈਆਂ ਕੋਲ ਟਾਈਮ 'ਤੇ ਸਰ ਪੈਸਾ ਹੀ ਹੁੰਦਾ ਕਿਸੇ ਕੋਲ ਮੋਬਾਇਲ 'ਚ ਗੂਗਲ ਪੇ ਵੀ ਨਹੀਂ ਚੱਲ ਰਿਹਾ ਹੁੰਦਾ ਫਲਿਪਕਾਡ ਵੀ ਨਹੀਂ ਹੁੰਦਾ ਇਸ ਕਰਕੇ ਤੁਹਾਨੂੰ ਹਰ ਕਿਸੇ ਤੋਂ ਹਰ ਤਰੀਕੇ ਨਾਲ ਜਿਹੜਾ ਉਹ ਪੈਸਾ ਲੈਣਾ ਚਾਹੀਦਾ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੂੰ ਤਾਂ ਕਿ ਜਿਹੜਾ ਆਪਣਾ ਸਵਾਰੀ ਤੁਹਾਡਾ ਆਉਣ ਜਾਣ ਸਵਾਰੀ ਦੇ ਨਾਲ ਰਿਸ਼ਤਾ ਬਣਦਾ ਉਹ ਇਸੇ ਤਰ੍ਹਾਂ ਬਹੁਤ ਅੱਛੇ ਢੰਗ ਨਾਲ ਬਣਿਆ ਰਹੇ ਤਾਂ ਕਿ ਤੁਹਾਨੂੰ ਵੀ ਆਪਣਾ ਜਿਹੜਾ ਪੈਸਾ ਸਮੇਂ ਸਿਰ ਮਿਲ ਜਾਵੇ ਅਤੇ ਸਵਾਰੀ ਨੂੰ ਵੀ ਹੈ ਜਿਹੜੀ ਕੋਈ ਆਉਣ ਜਾਣ ਦੇ ਵਿੱਚ ਦਿੱਕਤ ਨਾ ਹੋਵੇ ਥੈਂਕ ਯੂ ਧੰਨਵਾਦ ਸਰ